ਹਾਂ ਤੁਸੀਂ ਜਿਵੇਂ ਤੁਸੀਂ ਪੁੱਛਿਆ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਤਿਉਹਾਰ ਕਿਵੇਂ ਮਨਾਉਂਦੇ ਹੋ ਸਾਡੇ ਪਰਿਵਾਰ ਵਿੱਚ ਸਾਰੇ ਤਿਉਹਾਰ ਬਹੁਤ ਵਧੀਆ ਤਰੀਕੇ ਨਾਲ ਮਨਾਏ ਜਾਂਦੇ ਹਨ ਜਿਵੇਂ ਕਿ ਦਿਵਾਲੀ ਹੋ ਗਈ ਲੋਹੜੀ ਹੋ ਗਈ ਦਿਵਾਲੀ ਵੇਲੇ ਘਰਾਂ ਵਿੱਚ ਦੀਵੇ ਜਲਾਉਂਦੇ ਹੈਗੇ ਅਤੇ ਵੱਖੋ ਵੱਖ ਤਰ੍ਹਾਂ ਦੀਆਂ ਮਠਿਆਈਆਂ ਬਣਦੀਆਂ ਅਸੀਂ ਫਿਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਜਾ ਕੇ ਦੀਵੇ ਜਲਾਉਂਦੇ ਹਾਂ ਉੱਥੇ ਮਠਿਆਈਆਂ ਦੇ ਕੇ ਆਉਂਦੇ ਹਾਂ ਅਰਦਾਸ ਕਰਦੇ ਹਾਂ ਗੇ ਸਰਬੱਤ ਦੇ ਭਲੇ ਦੀ ਫਿਰ ਲੋਹੜੀ ਹੋ ਗਿਆ ਲੋਹੜੀ 'ਤੇ ਸਾਰੇ ਇਕੱਠੇ ਹੋ ਕੇ ਪਾਥੀਆਂ ਬਾਲ ਕ ਪਾਥੀਆਂ ਧਰ ਕੇ ਲੱਕੜਾਂ ਧਰ ਕੇ ਉਸਨੂੰ ਲੋਹੜੀ ਬਲ ਲੋਹੜੀ ਬਾਲੀ ਜਾਂਦੀ ਹੈ ਫਿਰ ਉਸਤੇ ਤਿਲ ਸਿੱਟ ਕੇ ਇੱਛਰ ਆ ਦਲਿੱਦਰ ਜਾਹ ਦਾ ਗੀਤਾ ਦਾ ਗੀਤ ਕੀਤਾ ਜਾਂਦਾ ਹੈ ਉਸ ਉੱਤੇ ਗੁੜ ਰਿਉੜੀਆਂ ਆਦਿ ਵੰਡੀਆਂ ਜਾਂਦੀਆਂ ਹਨ ਅਤੇ ਜਿਹੜੇ ਲੋਕ ਉੱਥੇ ਆਏ ਲੋਹੜੀ ਆਏ ਹੁੰਦੇ ਹਨ ਉਹਨਾਂ ਨੂੰ ਵੀ ਗੁੜ ਰਿਉੜੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਭੋਜਨ ਅਤੇ ਦਿਵਾਲੀ ਦੇ ਮੌਕੇ ਵੱਖ ਵੱਖ ਤਰ੍ਹਾਂ ਦੇ ਪਕਵਾਨ ਬਣਦੇ ਆ ਮਿਠਾਈਆਂ ਬਣਦੀਆਂ ਅਤੇ ਦਿਵਾਲੀ ਵੇਲੇ ਲੋਕ ਘਰਾਂ ਨੂੰ ਸਜਾ ਘਰਾਂ ਨੂੰ ਸਜਾਇਆ ਜਾਂਦਾ ਹੈ ਰੰਗ ਰੋਗਨ ਕੀਤਾ ਜਾਂਦਾ ਹੈ ਅਤੇ ਬਹੁਤ ਸਾਰੀ ਸਜਾਵਟ ਕੀਤੀ ਜਾਂਦੀ